ਹਾਂ ਮੈਂ ਕਈ ਤਰ੍ਹਾਂ ਦੇ ਸੰਗੀਤ ਵਾਲੇ ਸਾਜ ਵਜਾ ਲੈਂਦਾ ਹਾਂ ਜਿਵੇਂ ਕਿ ਹਰਮੋਨੀਅਮ ਢੋਲਕੀ ਔਰ ਸ਼ੈਣੇ ਵਗੈਰਾ ਪਰ ਮੈਂ ਇਸ ਉਮਰ ਵਿੱਚ ਤਬਲਾ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਤਬਲਾ ਸਿੱਖ ਰਿਹਾ ਹਾਂ ਇਸ ਇ ਅ ਹੁਨਰ ਨੂੰ ਸਿੱਖ ਕੇ ਮੈਂ ਹੋਰ ਅੱਗੇ ਲੈਵਲ 'ਤੇ ਜਾਣਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਮੈਂ ਪੂਰੀ ਤਨੋ ਮਨੋ ਹੋ ਕੇ ਇਸ ਹੁਨਰ ਨੂੰ ਸਿੱਖਾਂ ਔਰ ਵਧੀਆ ਤਰ੍ਹਾਂ ਦਾ ਤਬਲਾ ਵਜਾ ਕੇ ਇੱਕ ਵਧੀਆ ਤਰ੍ਹਾਂ ਦਾ ਤਬਲਾ ਵਜਾਉਣ ਦਾ ਮਾਹਿਰ ਬਣ ਕੇ ਇਸ ਪੈਸ਼ਨ ਵਿੱਚ ਜਾਣਾ ਚਾਹੁੰਦਾ ਹਾਂ ਮੈਨੂੰ ਤਬਲਾ ਵਜਾਉਣਾ ਬਹੁਤ ਹੀ ਵਧੀਆ ਲੱਗਦਾ ਹੈ ਔਰ ਤਬਲੇ ਦੀ ਧੁੰਨ ਜਦੋਂ ਵੀ ਕਿਤੇ ਤਬਲਾ ਵੱਜਦਾ ਹੈ ਤਾਂ ਮੇਰਾ ਮਨ ਬਹੁਤ ਸ਼ਾਂਤ ਹੁੰਦਾ ਹੈ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਤਬਲਾ ਵੱਜ ਰਿਹਾ ਹੈ ਅਤੇ ਤਬਲਾ ਵਜਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ